ਸਾਡੇ ਦੇਸ਼ ਵਿੱਚ ਬਹੁਤ ਜ਼ਿਆਦਾ ਤਿਉਹਾਰ ਮਨਾਏ ਜਾਂਦੇ ਹਨ ਜਿਵੇਂ ਕਿ ਦੀਵਾਲੀ ਦੁਸ਼ਹਿਰਾ ਲੋਹੜੀ ਮਾਘੀ ਹੋਲਾ ਮਹੱਲਾ ਵਿਸਾਖੀ ਆਦਿ ਮਨਾਏ ਜਾਂਦੇ ਹਨ ਜਿਸ ਵਿੱਚੋਂ ਮੇਨ ਮੇਰਾ ਮਨਪਸੰਦ ਤਿਉਹਾਰ ਵਿਸਾਖੀ ਹੈ ਵਿਸਾ ਵਿਸਾਖੀ ਕਣਕ ਵੱਢਣ ਦੀ ਖੁਸ਼ੀ ਵਿੱਚ ਮਨਾਈ ਜਾਂਦੀ ਹੈ ਇਸ ਦਿਨ ਕਿਸਾਨ ਕਿਸਾਨਾਂ ਦੀ ਫਸਲ ਵੱਢ ਕੇ ਤਿਆਰ ਹੋ ਜਾ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਉਹ ਇਸ ਖੁਸ਼ੀ ਵਿੱਚ ਵਿਸਾਖੀ ਮਨਾਈ ਜਾਂਦੀ ਮਨਾਉਂਦੇ ਹਨ ਅਤੇ ਵਿਸਾਖੀ ਦਾ ਮੇਲਾ ਅਨੰਦਪੁਰ ਮਨਾਇਆ ਜਾਂਦਾ ਹੈ ਮੈਂ ਆਪਣੇ ਬਚਪਨ ਵਿੱਚ ਇੱਕ ਵਾਰ ਮੇਲਾ ਦੇਖਿਆ ਸੀ ਅਨੰਦਪੁਰ ਅਨੰਦਪੁਰ ਅਨੰਦਪੁਰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਪੰਜ ਪੰਜ ਗੁਰੂਆਂ ਨੂੰ ਅੰਮ੍ਰਿਤ ਛਕਾਇਆ ਅਤੇ ਬਾਅਦ ਵਿੱਚ ਆਪ ਅੰਮ੍ਰਿਤ ਛਕਿਆ ਜਿਸ ਤੋਂ ਬਾਅਦ ਜਿਸ ਤੋਂ ਬਾਅਦ ਅੰਮ੍ਰਿਤ ਛਕਣ ਦੀ ਸ਼ੁਰੂਆਤ ਹੋਈ ਮੈਂ ਬਚਪਨ ਵਿੱਚ ਅਨੰਦਪੁਰ ਗਈ ਸੀ ਅਤੇ ਜਿ ਜਿੱਥੇ ਕਿ ਮੈਂ ਖੋ ਚੁੱਕੀ ਤੇ ਇੱਕ ਇੱਕ ਗੁਰੂ ਇੱਕ ਬਾਬਾ ਜੀ ਨੇ ਮੇਰੇ ਖੋਣ ਦੀ ਅਨਾਊਸਮੈਂਟ ਕਰਵਾਈ ਅਤੇ ਮੇਰੇ ਮਾਤਾ ਪਿਤਾ ਨੂੰ ਮੇਰੇ ਕੋਲ਼ ਮਿਲਵਾਇਆ ਅਤੇ ਮੈਂ ਬਚਪਨ ਅਸੀਂ ਬਚ ਬਹੁਤ ਜ਼ਿਆਦਾ ਭੀੜ ਹੋਣ ਕਰਕੇ ਮੈਂ ਗਵਾਚ ਗਈ ਅਤੇ ਮੈਂ ਮੇਲੇ ਵਿੱਚੋਂ ਇੱਕ ਗੁੱਡੀ ਖ਼ਰੀਦੀ ਅਤੇ ਉਹ ਗੁੱਡੀ ਅੱਜ ਵੀ ਮੇਰੇ ਕੋਲ਼ ਹੈ ਜਿਸ ਨੂੰ ਦੇਖਕੇ ਮੈਨੂੰ ਆਪਣੇ ਬਚਪਨ ਦਾ ਵਿਸਾਖੀ ਮੇਲਾ ਦੇਖਣ ਦੀ ਯਾਦ ਆ ਜਾਂਦੀ ਹੈ ਮੈਂ ਚਾਹੁੰਦੀ ਹਾਂ ਕਿ ਮੈਂ ਇਸ ਵਾਰ ਫ਼ਿਰ ਆਪਣੀ ਯਾਦ ਨੂੰ ਯਾਦਗਾਰ ਬਣਾਵਾਂ ਅਤੇ ਇਸ ਵਾਰ ਫ਼ਿਰ ਵਿਸਾਖੀ ਦੇ ਮੇਲੇ 'ਤੇ ਜਾਵਾਂ